ਹੈਲੋ ਹਾਂਜੀ ਡੋਕਟਰ ਸਾਹਿਬ ਸਤਿ ਸ਼੍ਰੀ ਅਕਾਲ ਡੋਕਟਰ ਸਰ ਹਾਂ ਸਰ ਮੈਂ ਨਾ ਯਸ਼ ਬੋਲਦਾ ਸੀਗਾ ਅਤੇ ਮੈਂ ਤੁਹਾਨੂੰ ਇਹੀ ਪੁੱਛਣਾ ਸੀ ਮੇਰਾ ਨਾ ਤਬੀਅਤ ਬਹੁਤ ਖ਼ਰਾਬ ਹੋਈ ਹੋਈ ਆ ਅੱਜ ਸਰ ਅੱਜ ਨਹੀਂ ਵੈਸੇ ਕੁਛ ਦਿਨਾਂ ਤੋਂ ਬਹੁਤ ਮੈਨੂੰ ਪ੍ਰੋਬਲਮ ਆ ਰਹੀ ਹੈ ਮੇਰੇ ਮਤਲਬ ਮੂੰਹ 'ਤੇ ਵੀ ਦਾਣੇ ਹੋ ਗਏ ਨੇ ਬੋਡੀ ਬਹੁਤ ਮੇਰੇ ਦਰਦ ਕਰ ਜਾਂਦੀ ਹੈ ਅਤੇ ਬਾਕੀ ਮੇਰੀ ਲੱਤਾਂ 'ਚ ਵੀ ਬਹੁਤ ਦਰਦ ਰਹਿ ਰਿਹਾ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਅੱਜ ਕੱਲ੍ਹ ਸਰ ਹੋ ਗਏ ਮੈਨੂੰ ਇੱਕ ਦੋ ਦਿਨ ਕਿ ਆਹ ਦੇਖਦੇ ਦੇਖਦੇ ਪਹਿਲੇ ਮੈਨੂੰ ਲੱਗਿਆ ਸੀਗਾ ਕਿ ਮੈਂ ਥੱਕ ਗਿਆ ਵਾਂ ਸ਼ਾਇਦ ਤਾਂ ਇੱਦਾਂ ਹੋ ਰਿਹਾ ਵਾ ਪਰ ਮੈਂ ਹੁਣ ਦੇਖ ਰਿਹਾ ਵਾਂ ਦਾਣੇ ਵੀ ਇਕਦਮ ਹੋ ਰਹੇ ਨੇ ਬੋਡੀ 'ਤੇ ਅਤੇ ਬਾਕੀ ਮੈਂ ਥਾਂ ਮਤਲਬ ਮੇਰੀ ਲੱਤਾਂ ਵੀ ਬਹੁਤ ਦਰਦ ਕਰੀ ਜਾਂਦੀਆਂ ਨੇ ਦੋ ਦਿਨ ਹੋ ਗਏ ਅੱਜ ਹਾਂਜੀ ਸਰ ਗਲ਼ਾ ਵੀ ਬਹੁਤ ਖ਼ਰਾਬ ਹੈ ਅਤੇ ਮੇਰਾ ਨੱਕ ਤੋਂ ਵੀ ਬਹੁਤ ਪਾਣੀ ਨਿਕਲੀ ਜਾ ਰਿਹਾ ਕਿਤੇ ਵੀ ਹੋਰ ਰਹੇ ਨੇ ਨਾ ਇਹ ਥੋੜ੍ਹਾ ਜਿਹਾ ਹਾਂਜੀ ਸਰ ਜਿਵੇਂ ਆਪਣੀਆਂ ਰੈਗੂਲਰ ਦਵਾਈਆਂ ਹੁੰਦੀਆਂ ਬੁਖ਼ਾਰ ਦੀ ਜਿਵੇਂ ਆ ਡੋਲੋ ਹੋ ਗਈ ਪੈਰਾਸੀਟਾਮੋਲ ਹੋ ਗਈ ਇਹ ਮੈਂ ਲੈ ਚੁੱਕਿਆ ਵਾਂ ਹੁਣ ਅੱਜ ਮੈਨੂੰ ਜਿਆਦਾ ਪ੍ਰੋਬਲਮ ਹੋ ਰਹੀ ਹੈ ਨਹੀਂ ਸਰ ਕੋਈ ਫਰਕ ਨਹੀਂ ਹੈਗਾ ਨਹੀਂ ਜੀ ਨਹੀਂ ਸਰ ਮੈਨੂੰ ਨਾ ਤਾਂ ਹੀ ਤਿੰਨ ਸਾਲ ਪਹਿਲਾਂ ਜਿਹੜਾ ਕੋਵਿਡ ਆਇਆ ਸੀ ਉਹਦੇ ਵਿੱਚ ਮੈਨੂੰ ਸਟੇਜ ਟੂ ਦਾ ਕੋਵਿਡ ਹੋ ਗਿਆ ਸੀਗਾ ਅਤੇ ਉਸ ਤੋਂ ਬਾਅਦ ਅਤੇ ਨਾ ਮੈਨੂੰ ਪੇਨ ਤਾਂ ਮੇਰੀ ਬੋਡੀ 'ਚ ਰਹਿੰਦਾ ਹੀ ਰਹਿੰਦਾ ਨੋਰਮਲ ਵੀ ਅਤੇ ਉਸ ਤੋਂ ਬਾਅਦ ਜੀ ਮੈਨੂੰ ਥੋੜ੍ਹਾ ਇਹੀ ਡਰ ਸੀ ਜਿਵੇਂ ਦਾਣੇ ਵੀ ਹੋ ਰਹੇ ਨੇ ਅਤੇ ਹੋਰ ਵੀ ਮੇਰਾ ਮਤਲਬ ਪ੍ਰੋਬਲਮ ਆ ਰਹੀਆਂ ਨੇ ਹਾਂਜੀ ਹਾਂਜੀ ਇੱਕ ਨਾ ਮੇਰਾ ਹਾਂਜੀ ਹਾਂਜੀ

ਹਾਂਜੀ ਡੋਕਟਰ ਸਰ ਇੱਕ ਮੈਂ ਪੁੱਛਣਾ ਸੀਗਾ ਕਿ ਮੈਨੂੰ ਕੁਛ ਹਜ਼ਮ ਵੀ ਨਹੀਂ ਹੋ ਰਿਹਾ ਹੈਗਾ ਮੈਨੂੰ ਮਤਲਬ ਨਾ ਬਹੁਤ ਜ਼ਿਆਦਾ ਕੁਛ ਮੈਂ ਖਾ ਰਿਹਾ ਉਲਟੀ ਆਈ ਜਾਂਦੀ ਵਾਰ ਵਾਰ ਸਰ ਦਾਲ ਵੀ ਨਹੀਂ ਹਜ਼ਮ ਹੋ ਰਹੀ ਦਾਲ ਵੀ ਨੀ ਹਜ਼ਮ ਹੋਈ ਮੈਂ ਉਹ ਵੀ ਕੋਸ਼ਿਸ਼ ਕੀਤੀ ਸੀ ਹਾਂਜੀ ਹਾਂਜੀ ਹਾਂਜੀ ਅਤੇ ਦਵਾਈ ਸਰ ਦੱਸੋ ਫਿਰ ਹੁਣ ਕਿਹੜੀ ਰੈਫਰ ਕਰਾਂ ਇੰਨੀ ਦੇਰ ਦਾ ਮਤਲਬ ਕੋਈ ਫਰਕ ਨਹੀਂ ਪਿਆ ਹੈਗਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ

ਬਾਕੀ ਇੱਕ ਮੈਨੂੰ ਇਹ ਸੀਗਾ ਕਿ ਮੇਰਾ ਜਿਹੜਾ ਦਾਣੇ ਹੋ ਰਹੇ ਨੇ ਇਕਦਮ ਹੀ ਹੋਣ ਲੱਗੇ ਨੇ ਮਤਲਬ ਅਤੇ ਹੁਣ ਇਹਨਾਂ ਦਾ ਬਈ ਕੀ ਕਰਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਡੋਕਟਰ ਸਰ ਹਾਂਜੀ ਹਾਂਜੀ ਸਰ ਹਾਂਜੀ ਸਰ ਠੀਕ ਹੈ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਓਕੇ ਜੀ ਓਕੇ